ਹਾਂਜੀ ਇਹ ਸੱਚ ਹੈ ਕਿ ਮੇਰੇ ਖੇਤਰ ਵਿੱਚ ਬਹੁਤ ਸਾਰੀਆਂ ਖੇਡਾਂ ਖੇਡੀਆਂ ਜਾਂਦੀਆਂ ਹਨ ਮੰਨ ਲਓ ਕਿ ਸਕੂਲ ਲੈਵਲ ਦੇ ਵਿੱਚ ਸਕੂਲ ਦੇ ਵਿੱਚ ਬਹੁਤ ਸਾਰੇ ਬੱਚੇ ਗੇਮਾਂ ਖੇਡਦੇ ਹਨ ਅਤੇ ਹਰ ਤਰ੍ਹਾਂ ਦੀ ਗੇਮ ਹੁੰਦੀ ਹੈ ਮ ਜਿਵੇਂ ਕਿ ਹਾਕੀ ਫੁੱਟਬਾਲ ਕਬੱਡੀ ਵਾਲੀਬਾਲ ਅਤੇ ਹੋਰ ਵੀ ਬਹੁਤ ਸਾਰੀਆਂ ਗੇਮਾਂ ਜੋ ਕਿ ਬੱਚੇ ਬਹੁਤ ਹੀ ਇੰਟਰਸਟ ਦੇ ਨਾਲ਼ ਖੇਡਦੇ ਹਨ ਅਤੇ ਹਰੇਕ ਗੇਮ ਵਿੱਚ ਭਾਗ ਲੈਂਦੇ ਹਨ ਅਤੇ ਸਕੂਲ ਦੇ ਸਾਰੇ ਵਿਦਿਆਰਥੀ ਸ਼ਾਮ ਨੂੰ ਉਸ ਗਰਾਊਂਡ ਵਿੱਚ ਇਕੱਠੇ ਹੋ ਕੇ ਗੇਮਾਂ ਖੇਡਦੇ ਹਨ ਆਨੰਦ ਮਾਣਦੇ ਹਨ ਜਦ ਕਿ ਇਸ ਤੋਂ ਇਲਾਵਾ ਪੁਲਿਸ ਪੁਲਿਸ ਵਿਭਾਗ ਦੇ ਕਰਮਚਾਰੀ ਵੀ ਆਪਣੇ ਬੜੇ ਗਰਾਊਂਡ ਵਿੱਚ ਆਉਂਦੇ ਹਨ ਅਤੇ ਉੱਥੇ ਆਪਣਾ ਟਾਈਮ ਸਪੈਂਡ ਕਰਦੇ ਹਨ ਅਤੇ ਆਪਣੇ ਆਪ ਨੂੰ ਫਿੱਟ ਰੱਖਣ ਲਈ ਬਹੁਤ ਸਾਰੀਆਂ ਐਕਸਰਸਾਈਜ਼ਾਂ ਵਗੈਰਾ ਅਤੇ ਰਨਿੰਗ ਵਗੈਰਾ ਕਰਦੇ ਹਨ ਅਤੇ ਬਹੁਤ ਜ਼ਿਆਦਾ ਬਹੁਤ ਸਾਰੀਆਂ ਪ੍ਰਭਾਵਿਤ ਗੇਮਾਂ ਜਿਵੇਂ ਕਿ ਫੁੱਟਬਾਲ ਕਬੱਡੀ ਵਾਲੀਬਾਲ ਅਤੇ ਹੋਰ ਵੀ ਕੁਝ ਗੇਮਾਂ ਜੋ ਕਿ ਖੇਡੀਆਂ ਜਾਂਦੀਆਂ ਹਨ ਅਤੇ ਅਤੇ ਸਾਡੇ ਪਿੰਡਾਂ ਦੇ ਵਿੱਚ ਵੀ ਵੱਖ ਵੱਖ ਜਗ੍ਹਾ 'ਤੇ ਬਹੁਤ ਸਾਰੇ ਗਰਾਊਂਡ ਹਨ ਜਿੱਥੇ ਇਹ ਪਿੰਡਾਂ ਦੇ ਲੋਕ ਖ਼ਾਸ ਤੌਰ 'ਤੇ ਬੱਚੇ ਪਹੁੰਚਦੇ ਹਨ ਅਤੇ ਕੁਝ ਸਾਰਾ ਸਮਾਂ ਇਕੱਠਾ ਬਤੀਤ ਕਰਦੇ ਹਨ ਅਤੇ ਖੇਡਾਂ ਖੇਡਦੇ ਹਨ ਅਤੇ ਮਨੋਰੰਜਨ ਕਰਦੇ ਹਨ ਇਹ ਬਹੁਤ ਹੀ ਵਧੀਆ ਮੰਨਿਆ ਜਾਂਦਾ ਹੈ ਕਿ ਖੇਡ ਇੱਕ ਮਨੋਰੰਜਨ ਦਾ ਸਾਧਨ ਹੈ ਜਿਸ ਵਿੱਚ ਬੱਚੇ ਜਾਂ ਕੋਈ ਵੀ ਵਿਅਕਤੀ ਫਿੱਟ ਵੀ ਹੁੰਦਾ ਹੈ ਅਤੇ ਖੁਸ਼ ਵੀ ਰਹਿੰਦਾ ਹੈ ਅਤੇ ਆਪਣੇ ਲੋਕਲ ਲੋਕਾਂ ਨਾਲ ਸਮਾਂ ਵੀ ਬਤੀਤ ਕਰਦਾ ਹੈ ਅਤੇ ਬਹੁਤ ਜ਼ਿਆਦਾ ਇੰਜੋਏ ਕਰਦਾ ਹੈ ਅਤੇ ਖੇਡ ਨੂੰ ਸਾਡੇ ਪੰਜਾਬ ਵਿੱਚ ਜਾਂ ਸਾਡੇ ਏਰੀਏ ਵਿੱਚ ਮੰਨਿਆ ਜਾਂਦਾ ਹੈ ਕਿ ਇਹ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਹੈ ਇਸ ਨਾਲ ਨਸ਼ਿਆਂ ਤੋਂ ਵੀ ਮੁਕਤ ਕੀਤਾ ਜਾ ਸਕਦਾ ਹੈ ਜੇ ਕੋਈ ਵਿਅਕਤੀ ਮੰਨ ਲਵੋ ਕਿ ਗਲਤ ਰਸਤੇ ਪੈਂਦਾ ਹੈ ਤਾਂ ਉਸ ਨੂੰ ਗਰਾਊਂਡ ਦੇ ਵਿੱਚ ਲੈ ਕੇ ਆਇਆ ਜਾਵੇ ਅਤੇ ਉਸਨੂੰ ਉੱਥੇ ਖਿਡਾਇਆ ਜਾਵੇ ਤਾਂ ਜੋ ਉਸਦਾ ਧਿਆਨ ਗਲਤ ਕੰਮਾਂ ਵੱਲ ਨਾ ਭੜਕੇ